ਬੁਨਾਈ ਅਤੇ ਸਲਾਈ ਦੇ ਮਹੱਤਵਪੂਰਨ ਚੀਜ਼ਾਂ ਜਿਵੇਂ ਕੀ ਐੱਲ ਸ਼ੇਪ ਪੱਟੀ ਸਿੱਧੀ ਐੱਲ ਸ਼ੇਪ ਪੱਟੀ ਸਿੱਧੀ ਜਾਂ ਥੋੜੀ ਗੋਲਾਈ ਦੇ ਵਿੱਚ ਮਤਲਬ ਗੁਲਾਈ ਕਰਨ ਵਾਸਤੇ ਉਹਦੇ ਵਾਸਤੇ ਵਰਤੀ ਜਾਂਦੀ ਹੈ ਇੱਕ ਸਿੱਧੀ ਪੱਟੀ ਹੁੰਦੀ ਹੈ ਉਹ ਸਿੱਧੀ ਲਾਈਨ ਵੀ ਜਿਵੇਂ ਆਪਾਂ ਸਿੱਧੀ ਲਾਈਨ ਖਿਚਣੀ ਹੋਵੇ ਉਹਦੇ ਵਾਸਤੇ ਵਰਤੀ ਜਾਂਦੀ ਹੈ ਜਿਹੜੀ ਸਿੱਧੀ ਪੱਟੀ ਵਾਸਤੇ ਵਰਤਦੇ ਐ ਤੇ ਇਹ ਇੱਕ ਹੁੰਦੀ ਐ ਹਿੱਪ ਸ਼ੇਪ ਪੱਟੀ ਉਹ ਆਪਾਂ ਵੀ ਜਿਵੇਂ ਕੁੜਤੀ ਨੂੰ ਸ਼ੇਪ ਦੇਨ ਵਾਸਤੇ ਹਿੱਪ ਦੀ ਸ਼ੇਪ ਦੇਨ ਵਾਸਤੇ ਉਹਦੇ ਵਾਸਤੇ ਵਰਤਦੇ ਹਾਂ ਇੱਕ ਲੇਕ ਪੱਟੀ ਹੁੰਦੀ ਹੈ ਇਹਦੇ ਵਿੱਚ ਉਹ ਆਪਾਂ ਪਲਾਜ਼ੋ ਦੀ ਕਟਿੰਗ ਵਾਸਤੇ ਵਰਤਦੇ ਆਂ ਜਿਹੜੀ ਹਿਪ ਸ਼ੇਪ ਤੇ ਇੱਕ ਲੇਕ ਪੱਟੀ ਹੁੰਦੀ ਐ ਉਹਨਾਂ ਚ ਥੋੜਾ ਈ ਫ਼ਰਕ ਹੁੰਦਾ ਜਿਵੇਂ ਹਿੱਪ ਸ਼ੇਪ ਪੱਟੀ ਥੋੜੀ ਜਿਹੀ ਗੋਲਾਈ ਚ ਹੁੰਦੀ ਐ ਲੇਕ ਪੱਟੀ ਸਿੱਧੀ ਹੁੰਦੀ ਐ ਉਹਦੇ ਤੇ ਲਿਖਿਆ ਵੀ ਹੁੰਦਾ ਮਾਰਕਿੰਗ ਵੀ ਕੀਤੀ ਹੁੰਦੀ ਐ ਇੱਕ ਇਹਦੇ ਵਿੱਚ ਅਸੀਂ ਵਰਤਦੇ ਆਂ ਮੇਨ ਟੂਲ ਹੈਗਾ ਸੀਜ਼ਰ ਜਿਹੜਾ ਅਸੀਂ ਕੱਪੜਾ ਕਟਿੰਗ ਵਾਸਤੇ ਵਰਤਦੇ ਆਂ ਇੱਕ ਛੋਟੀ ਸੀਜ਼ਰ ਹੁੰਦੀ ਐ ਜੋ ਅਸੀਂ ਛੋਟੇ ਮੋਟੇ ਧਾਗੇ ਜਿਹਨੂੰ ਸਟਿੱਚ ਕਰਦੇ ਹੋਏ ਥੋੜੇ ਬਹੁਤੇ ਧਾਗੇ ਬਚ ਜਾਂਦੇ ਆ ਜਿਵੇਂ ਉਹ ਛੋਟੀ ਸੀਜ਼ਰ ਵਰਤਦੇ ਉਹਦੇ ਵਾਸਤੇ ਇੱਕ ਮੇਨ ਟੂਲ ਹੁੰਦਾ ਸਟਿੱਚ ਓਪਨਿੰਗ ਹੁੰਦਾ ਸਟਿੱਚ ਓਪਨਿੰਗ ਜਿਵੇਂ ਕੀ ਆਪਾਂ ਸਿਲਾਈ ਜਿਵੇਂ ਆਪਣੀ ਥੋੜੀ ਬਹੁਤੀ ਸਲਾਈ ਆਪਾਂ ਨੂੰ ਨਹੀਂ ਸੈੱਟ ਆਈ ਤੇ ਅਸੀਂ ਸਲਾਈ ਉਹ ਧੇੜਨੀ ਐ ਜਿਵੇਂ ਉਹਦੇ ਵਾਸਤੇ ਵਰਤਦੇ ਆਂ ਇੱਕ ਟਰੇਸਿੰਗ ਹੋਲ ਹੁੰਦਾ ਟਰੇਸਿੰਗ ਵੀਲ ਜਿਵੇਂ ਵੀ ਵੀ ਡਬਲ ਕੱਪੜਾ ਰੱਖਿਆ ਵਿਆ ਟਰੇਸ ਕਰਨਾ ਹੈਗਾ ਨਿਸ਼ਾਨ ਲਗਾਣਾ ਜਿਵੇਂ ਟਰੇਸ ਕੀਤਾ ਉਹ ਨੀਚੇ ਵਾਲੇ ਕੱਪੜੇ ਤੇ ਵੀ ਟਰੇਸ ਹੋ ਜਾਵੇ ਇਦਾਂ ਹੁੰਦਾ ਹੈਗਾ ਉਹ ਇਸ ਵਾਸਤੇ ਵਰਤਦੇ ਆਂ ਇੱਕ ਚਾਕ ਵਰਤਦੇ ਆਂ ਮੇਨ ਇੱਕ ਮੇਨ ਹੁੰਦਾ ਹੈਗਾ ਮੇਨ ਇਹਦੇ ਵਿੱਚ ਟੂਲ ਹੈਗਾ ਜਿਵੇਂ ਨੀਡਲ ਅਸੀਂ ਆਮ ਵੀ ਆਮ ਤਾਂ ਵੈਸੇ ਚੌਦਾਂ ਨੰਬਰ ਨੀਡਲ ਵਰਤਦੇ ਆਂ ਵੈਸੇ ਅਲੱਗ ਅਲੱਗ ਕੱਪੜਿਆਂ ਤੇ ਅਲੱਗ ਅਲੱਗ ਨੀਡਲ ਈ ਵਰਤੀ ਜਾਂਦੀ ਐ ਤੇ ਇੱਕ ਕਿਨਮ ਹੈਗੇ ਐ ਹੁੰਦਾ ਇਹਦੇ ਵਿੱਚ ਜਿਵੇਂ ਮੇਨ ਤਾਂ ਓ ਉਦਾਂ ਤਾਂ ਵੀ ਚੌਦਾਂ ਨੰਬਰ ਨੀਡਲ ਈ ਵਰਤਦੇ ਆ ਬਾਕੀ ਅਲੱਗ ਅਲੱਗ ਕੱਪੜੇ ਤੇ ਜਿਵੇਂ ਅਲੱਗ ਅਲੱਗ ਸੂਈਆਂ ਵੀ ਮਨ ਅਲੱਗ ਅਲੱਗ ਨੀਡਲ ਵਰਤਦੇ ਆਂ ਇੱਕ ਇਹਦੇ ਵਿੱਚ ਹੁੰਦਾ ਇੰਚੀਟੇਪ ਉਹਦੇ ਬਿਨ੍ਹਾਂ ਤਾਂ ਕੰਮ ਵੀ ਨੀ ਚੱਲਦਾ ਤੇ ਇੱਕ ਹੁੰਦਾ ਇਹਦੇ ਚ ਆਰਮ ਹੋਲ ਜੋ ਮੋਢੇ ਦੀ ਕਟਾਈ ਵਾਸਤੇ ਯੂਜ਼ ਕੀਤਾ ਜਾਂਦਾ ਹੈਗਾ ਤੇ ਇੱਕ ਜਿਵੇਂ ਹੁਨ ਹੈ ਵੀ ਇਸ ਇਹਨੂੰ ਬਿਹਤਰ ਬਨਾਉਣ ਲਈ ਅਸੀਂ ਹੋਰ ਕੀ ਖਰੀਦੀਏ ਮਤਲਬ ਇਹਨੂੰ ਬੇਤਰ ਵੀ ਜਿਵੇਂ ਆ ਅਸੀਂ ਕਹਿਨੇ ਵੀ ਜਿਵੇਂ ਹੁਨ ਅੱਜ ਕੱਲ ਦੀਆਂ ਮਸ਼ੀਨਾਂ ਹੈਗੀਆਂ ਨਵੀਆਂ ਮਸ਼ੀਨਾਂ ਵੀ ਉਹ ਇੱਛਾ ਹੈਗੀ ਐ ਵੀ ਜਿਵੇਂ ਅਸੀਂ ਖਰੀਦ ਸਕੀਏ ਤਾਂ ਅਸੀਂ ਉਹ ਖਰੀਦਨਾ ਚਾਹੁਨੇ ਆਂ